ਪ੍ਰਵੇਸ਼ ਦੁਆਰ 'ਤੇ ਗੋਬਰ ਨੂੰ ਪਾਣੀ ਵਿੱਚ ਮਿਲਾ ਕੇ ਛਿੜਕਣ ਛਿੜਕਣਾ ਜਾਂ ਫਿਰ ਇਸ ਨੂੰ ਲਿੱਪਣਾ ਪੁਰਾਣੇ ਸਮੇਂ ਦੇ ਵਿੱਚ ਅਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸ਼ਗਨ ਮੰਨਿਆ ਜਾਂਦਾ ਹੈ ਜਦੋਂ ਵੀ ਕਦੇ ਵਿਆਹ ਕਿਸੇ ਦਾ ਵਿਆਹ ਹੁੰਦਾ ਸੀ ਜਾਂ ਸ਼ੁੱਭ ਸ਼ਗਨ ਕਰਨੇ ਹੁੰਦੇ ਸੀ ਤਾਂ ਪਰਮੇਸ਼ਰ ਦੁਆਰ ਉੱਤੇ ਗੋਬਰ ਦੀ ਪਾਣੀ ਦੇ ਨਾਲ ਲਿਪਾਈ ਕੀਤੀ ਜਾਂਦੀ ਸੀ ਅਤੇ ਇਸ ਦੇ ਨਾਲ ਜਿਹੜਾ ਕਿ ਸਾਡਾ ਕੰਮ ਹੋਣ ਵਾਲਾ ਹੈ ਉਹ ਸ਼ੁੱਭ ਹੋਵੇ ਇਸ ਕਰਕੇ ਇਹ ਕੀਤਾ ਜਾਂਦਾ ਸੀ